ਮੈਂ ਅਜਿਹੇ ਵਿਅਕਤੀ ਲਈ ਇਹ ਸਲਾਹ ਦੇਵਾਂਗੀ ਕਿ ਉਹ ਯੂਟਿਊਬ ਰਾਹੀਂ ਨਵਾਂ ਸਿੱਖੇ ਕੁੱਝ ਵੀ ਨਵਾਂ ਸਿੱਖੇ ਅਤੇ ਉਸ 'ਤੇ ਵੀਡੀਓਜ਼ ਬਣਾ ਬਣਾ ਕੇ ਆਪਣੀ ਚਿੱਤਰਕਲਾ ਨੂੰ ਦਰਸਾਵੇ ਜਾਂ ਉਸ ਤੋਂ ਹੋਰ ਵੀ ਜ਼ਿਆਦਾ ਸਿੱਖੇ ਅਤੇ ਇੱਕ ਉਪਾਅ ਇਸ ਦਾ ਹੋਰ ਵੀ ਹੈ ਕਿ ਉਹ ਕਿਸੀ ਅਧਿਆਪਕ ਜਾਂ ਚਿੱਤਰ ਦੇ ਚਿੱਤਰਕਾਰ ਦੇ ਉਸਤਾਦ ਰਾਹੀਂ ਉਹ ਇਸ ਸਭ ਕੁੱਝ ਸਿੱਖੇ ਚਿੱਤਰਕਾਰੀ ਬਾਰੇ